ਹੈਲੋ ਹਾਂਜੀ ਮੈਮ ਹਾਂਜੀ ਮੈਮ ਅਸੀਂ ਫ਼ੋਨ ਲਾਇਆ ਤਾ ਅਤੇ ਅਸੀਂ ਨੇ ਨਾ ਇੱਥੇ ਮੋਹਾਲੀ ਚੰਡੀ ਨਵੇਂ ਨਵੇਂ ਸ਼ਿਫਟ ਹੋਏ ਹਾਂ ਅਤੇ ਅਸੀਂ ਸਾਡੀ ਮੈਰਿਜ਼ ਆ ਅਤੇ ਹੈ ਨਾ ਅਸੀਂ ਨੇ ਸਮਾਨ ਲੈਣਾ ਸੀਗਾ ਸਾਰੀ ਫੈਮਿਲੀ ਉਰੇ ਨਵੀਂ ਸ਼ਿਫਟ ਹੋਈ ਆ ਅਤੇ ਸਾਨੂੰ ਜੀ ਇੱਧਰ ਬਜ਼ਾਰ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਸਾਨੂੰ ਦੱਸ ਸਕਦੇ ਹਾਂ ਤੁਸੀਂ ਮੈਮ ਮੇਰਾ ਨਾਮ ਸੋਨੀਆ ਮੈਮ ਅਸੀਂ ਜੁੱਤੀਆਂ ਲੈਣੀਆਂ ਜੀ ਵਿਆਹ ਵਾਸਤੇ ਅਤੇ ਕੱਪੜੇ ਵਗੈਰਾ ਲੈਣੇ ਆ ਹਾਂਜੀ ਮੈਮ ਫੁੱਲਕਾਰੀਆਂ ਵੀ ਹਾਂਜੀ ਮੈਮ ਵਧੀਆ ਕੁਆਲਿਟੀ ਦੇ ਲੈਣੇ ਆ ਹਾਂਜੀ ਮੈਮ ਨਹੀਂ ਨਹੀਂ ਮੈਮ ਜਿੱਥੇ ਜ਼ਿਆਦਾ ਵਰਾਇਟੀਆਂ ਹੋਣ ਵਧੀਆ ਠੀਕ ਹੈ ਮੈਮ ਹਾਂਜੀ ਮੈਮ ਓਕੇ ਮੈਮ ਓਕੇ ਮੈਮ ਠੀਕ ਹੈ ਮੈਮ ਓਕੇ ਮੈਮ ਥੈਂਕ ਯੂ ਜੀ